ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕੀ ਹਾਲ ਚਾਲ ਹੈ ਤੁਸੀਂ ਢਿੱਲੋਂ ਟਰੈਵਲ ਏਜੰਸੀ ਤੋਂ ਬੋਲ ਰਹੇ ਹੋ ਭਾਅ ਜੀ ਮੈਂ ਭਾਅ ਜੀ ਤੁਹਾਡੀ ਗੱਡੀ ਬੁੱਕ ਕੀਤੀ ਸੀ ਮੋਹਾਲੀ ਏਅਰਪੋਰਟ 'ਤੇ ਜਾਣ ਵਾਸਤੇ ਮੈਂ ਤਾਂ ਉਹਦੀ ਪੇਮੈਂਟ ਵੀ ਪਹਿਲਾਂ ਹੀ ਕਰ ਦਿੱਤੀ ਸੀ ਔਨਲਾਈਨ ਇੱਕ ਤਾਂ ਮੈਂ ਡਰਾਈਵਰ ਨੂੰ ਦੱਸਿਆ ਸੀ ਕਿ ਮੈਂ ਨੌਂ ਵਜੇ ਨੌਂ ਵਜੇ ਘਰੋਂ ਤੁਰ ਪੈਣਾ ਹੈ ਪਰ ਡਰਾਈਵਰ ਮੇਰੇ ਕੋਲ ਸਾਢੇ ਦਸ ਵਜੇ ਪੂਰਾ ਡੇਢ ਘੰਟਾ ਲੇਟ ਪੁੱਜਿਆ ਇੱਕ ਤਾਂ ਉਹ ਲੇਟ ਪੁੱਜਿਆ ਅਤੇ ਦੂਜਾ ਗੱਡੀ ਵੀ ਬਹੁਤ ਹੌਲੀ ਹੌਲੀ ਚਲਾ ਰਿਹਾ ਸੀ ਉਹਦੇ ਕਰਕੇ ਮੈਂ ਏਅਰਪੋਰਟ ' ਤੇ ਪਹੁੰਚਣ ਲਈ ਵੀ ਲੇਟ ਹੋ ਗਿਆ ਮੈਂ ਜ਼ਰੂਰੀ ਕੰਮ ਵੀ ਬਾਹਰ ਜਾਣਾ ਸੀ ਅਤੇ ਉਹਦੇ ਕਰਕੇ ਮੇਰੀ ਫਲਾਈਟ ਮਿਸ ਹੋ ਗਈ ਹੈ ਜਿਹਦੇ ਕਰਕੇ ਮੇਰਾ ਪੰਜਾਹ ਹਜ਼ਾਰ ਦਾ ਨੁਕਸਾਨ ਹੋ ਗਿਆ ਹੈ ਪਹਿਲਾਂ ਤੁਸੀਂ ਆਪਣੇ ਡਰਾਈਵਰ ਨੂੰ ਕਹੋ ਕਿ ਆਪਣੇ ਟਾਈਮ ਸਿਰ ਪੁੱਜੇ ਜਿਸ ਟਾਈਮ ਜਾਣਾ ਹੈ ਵੀ ਤਾਂ ਜੋ ਅਗਲੇ ਦਾ ਵੀ ਨੁਕਸਾਨ ਨਾ ਹੋਵੇ ਅਤੇ ਅਗਲਾ ਆਪਣੇ ਸਾਰੇ ਕੰਮ ਸਮੇਂ ਸਿਰ ਖਤਮ ਕਰ ਸਕੇ ਭਾਅ ਜੀ ਮੇਰੀ ਇੱਕ ਦਰਖੁਆਸ ਸੀਗੀ ਤੁਹਾਡੇ ਕੋਲ ਕਿ ਤੁਸੀਂ ਮੇਰਾ ਨੁਕਸਾਨ ਤਾਂ ਹੋ ਗਿਆ ਅਤੇ ਤੁਸੀਂ ਮੇਰੇ ਪੈਸੇ ਰਿਫੰਡ ਕਰ ਸਕਦੇ ਹੋ ਜੇ ਤੁਸੀਂ ਪੈਸੇ ਰਿਫੰਡ ਕਰ ਸਕਦੇ ਹੋ ਤਾਂ ਮੈਂ ਤੁਹਾਡਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ